ਅੱਜ ਦੀ ਟਕਨੋਲਜੀ ਦੇ ਨਾਲ ਜੀਵਨ ਦੇ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ ਪੁਰਾਣੇ ਜ਼ਮਾਨੇ ਵਿੱਚ ਹੱਥ ਨਾਲ ਮਸ਼ੀਨ ਸਿਲਾਈ ਕਰਕੇ ਕੱਪੜੇ ਸਿਲਾਈ ਕੀਤੇ ਜਾਂਦੇ ਸਨ ਅੱਜ ਦੇ ਜ਼ਮਾਨੇ ਵਿੱਚ ਅੰਬਰੇਲਾ ਮਸ਼ੀਨ ਨਾਲ ਮੋਟਰ ਚਲਾ ਕੇ ਕਈ ਸੂਟ ਸੀਤੇ ਜਾਂਦੇ ਹਨ ਅੱਜ ਕੱਲ੍ਹ ਪੀਕੋ ਵਾਲੀ ਮਸ਼ੀਨ ਇੰਟਰਲੋਕ ਵਾਲੀ ਮਸ਼ੀਨ ਕਈ ਮਸ਼ੀਨਾਂ ਆ ਗਈਆਂ ਹਨ ਅੱਜ ਕੱਲ੍ਹ ਦੀ ਟਕਨੋਲਜੀ ਨੇ ਬਹੁਤ ਤਰੱਕੀ ਕੀਤੀ ਹੈ